ਮੇਰੀਆਂ ਮਨਪਸੰਦ ਜਗ੍ਹਾ ਵਿੱਚੋਂ ਸਭ ਤੋਂ ਵਧੀਆ ਅਤੇ ਮਨਪਸੰਦ ਧਰਮ ਨਾਲ਼ ਜੁੜੀ ਹਰਿਮੰਦਰ ਸਾਹਿਬ ਹੈ ਜੋ ਅੰਮ੍ਰਿਤਸਰ ਵਿੱਚ ਹੈ ਅਤੇ ਮੈਨੂੰ ਅਤੇ ਇਹ ਮੇਰੇ ਬੱਚਿਆਂ ਨੂੰ ਬਹੁਤ ਵਧੀਆ ਜਗ੍ਹਾ ਲੱਗਦੀ ਹੈ ਅਤੇ ਅਸੀਂ ਇੱਥੇ ਮੱਥਾ ਟੇਕਣ ਜਾਂਦੇ ਹਨ ਅਤੇ ਮਨ ਦੀ ਸ਼ਰਧਾ ਪੂਰੀ ਹੁੰਦੀ ਹੈ ਅਤੇ ਮੱਥਾ ਟੇਕਣ ਤੋਂ ਬਾਅਦ ਇੱਥੋਂ ਗੁਰੂ ਘਰ ਦਾ ਲੰਗਰ ਛੱਕਦੇ ਹਨ ਉਹ ਤੋਂ ਬਾਅਦ ਇੱਥੇ ਵਾਘਾ ਬਾਰਡਰ 'ਤੇ ਪਰੇਡ ਦੇਖਦੇ ਹਨ ਅਤੇ ਮੈਨੂੰ ਇੱਥੋਂ ਇਹ ਪਰੇਡ ਦੇਖਣਾ ਮੱਥਾ ਟੇਕਣਾ ਗੁਰਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਅਤੇ ਮੱਥਾ ਟੇਕਣ ਤੋਂ ਬਾਅਦ ਦਿਲ ਨੂੰ ਜੋ ਸਕੂਨ ਮਿਲਦਾ ਹੈ ਉਹਦੇ ਨਾਲ਼ ਸਾਨੂੰ ਪਰਿਵਾਰ ਨੂੰ ਮੈਨੂੰ ਬਹੁਤ ਦਿਲ ਨੂੰ ਤਸੱਲੀ ਮਿਲਦੀ ਹੈ ਅਤੇ ਮੈਨੂੰ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਥੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਉਹ ਤੋਂ ਬਾਅਦ ਅਸੀਂ ਇੱਥੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਘੁੰਮਦੇ ਹਨ ਅਤੇ ਇੱਥੋਂ ਦਾ ਖਾਣਾ ਪੀਣਾ ਮੈਨੂੰ ਬਹੁਤ ਪਸੰਦ ਹੈ